ਜੀ ਹਾਂ ਸ ਸਾਡੇ ਰਾਜ ਦੇ ਕਲਾਤਮਕ ਉਤਪਾਦਾਂ ਨੂੰ ਰੋਕਣ ਜਾਂ ਕੋਪੀਰਾਈਟ ਕਰਨ ਦਾ ਸਾਧਨ ਹੈ ਜਿਵੇਂ ਕਿ ਫਲੈਟ ਫੀ ਆਰਟ ਲਾਈਸੈਂਸਿੰਗ ਕੰਟਰੈਕਟ ਅਤੇ ਕਾਪੀਰਾਈਟ ਲਾਈਸੈਂਸ ਫਲੈਟ ਫੀ ਆਰਟ ਲਾਈਸੈਂਸਿੰਗ ਕੰਟਰੈਕਟ ਇਹ ਹੁੰਦਾ ਹੈ ਜਦੋਂ ਜਿਵੇਂ ਕੋਈ ਕਲਾਕਾਰ ਹੈ ਉਹਨੇ ਆਪਣਾ ਕੋਈ ਉਤਪਾਦ ਵੇਚਣਾ ਹੈ ਜੇ ਬਾਜ਼ਾਰ ਵਿੱਚ ਉਹਨੂੰ ਵੇਚਦਾ ਹੈ ਉਸ ਨੂੰ ਜੇ ਲੱਗਦਾ ਹੈ ਕਿ ਉਸ ਨੂੰ ਉਸ ਤੋਂ ਬਾਅਦ ਉਸਦੀ ਕੀਮਤ ਬਾਜ਼ਾਰ ਵਿੱਚ ਵੱਧ ਗਈ ਹੈ ਅਤੇ ਉਸ ਨੂੰ ਘਾਟਾ ਪੈ ਰਿਹਾ ਤਾਂ ਉਹ ਇਸ ਲਾਈਸੈਂਸਿੰਗ ਕੋਂਟਰੈਕਟ ਨੂੰ ਲੈ ਸਕਦਾ ਹੈ ਜਿਸ ਵਿੱਚ ਉਹ ਜਦੋਂ ਆਪਣੇ ਉਤਪਾਦ ਨੂੰ ਵੇਚੇਗਾ ਤਾਂ ਉਸ ਨੂੰ ਉਸ ਦੇ ਪੈਸੇ ਮਿਲਣਗੇ ਅਤੇ ਉਹ ਇਸ ਨੂੰ ਆ ਕੁਛ ਫਿਕਸਡ ਟਾਈਮ ਲਈ ਰੱਖਦਾ ਹੈ ਜੇ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਬਾਅਦ ਵਿੱਚ ਘਾਟਾ ਪੈ ਰਿਹਾ ਹੈ ਤਾਂ ਉਹ ਉਸ ਨੂੰ ਬਾਅਦ 'ਚ ਦੁਬਾਰਾ ਖ੍ਰੀਦ ਸਕਦਾ ਹੈ ਅਤੇ ਆਪਣੇ ਉਤਪਾਦ ਦੀ ਰਕਮ ਵਧਾ ਕੇ ਦੁਬਾਰਾ ਵੇਚ ਸਕਦਾ ਹੈ ਕੋਪੀਰਾਈਟ ਲਾਈਸੈਂਸ ਉਦੋਂ ਹੁੰਦਾ ਹੈ ਜਿਵੇਂ ਕੋਈ ਬੁੱਕ ਪਬਲਿਸ਼ਰ ਹੈ ਜੇ ਉਸਨੇ ਕੋਈ ਬੁੱਕ ਪਬਲਿਸ਼ ਕੀਤੀ ਹੈ ਜੇ ਉਹ ਕਿਸੇ ਹੋਰ ਨੂੰ ਅੱਗੇ ਬਾਜ਼ਾਰ ਵਿੱਚ ਵੇਚਦਾ ਹੈ ਤਾਂ ਓਰੀਜਨਲ ਕਾਪੀਰਾਈਟ ਹੁੰਦੇ ਹੀ ਉਹੀ ਕਲਾਕਾਰ ਕੋਲ ਰਹਿੰਦਾ ਹੈ ਪਰ ਜਿਹੜਾ ਦੂਜਾ ਬੰਦਾ ਉਹ ਅੱਗੇ ਇਸ ਬੁੱਕ ਨੂੰ ਵੇਚ ਸਕਦਾ ਹੈ ਉਹ ਉਸਦੇ ਕਲਾਕਾਰ ਨੂੰ ਇਸ ਦੇ ਪੈਸੇ ਮਿਲਦੇ ਹਨ ਉਸ 'ਤੇ ਕੋਈ ਵੀ ਓਰੀਜਨਲ ਕਾਪੀਰਾਈਟ ਹੁੰਦਾ ਹੈ ਜਿਵੇਂ ਕਿ ਗਾਣੇ ਹੁੰਦੇ ਹਨ ਉਹਨਾਂ ਵਿੱਚ ਵੀ ਇਹੀ ਹੁੰਦਾ ਹੈ ਕਿ ਓਰੀਜਨਲ ਕਾਪੀਰਾਈਟ ਜਿਹੜਾ ਹੁੰਦਾ ਹੈ ਉਸੇ ਕਲਾਕਾਰ ਕੋਲ ਹੁੰਦਾ ਕੁਝ ਸਮੇਂ ਲਈ ਉਹ ਪੈਸੇ ਲੈ ਕੇ ਅੱਗੇ ਕਿਸੇ ਹੋਰ ਨੂੰ ਆਪਣਾ ਗਾਣਾ ਵੇਚ ਸਕਦਾ ਹੈ ਧੰਨਵਾਦ